ਮੈਂ ਆਪਣੇ ਸ਼ੁਰੂਆਤੀ ਜਾਂ ਬਚਪਨ ਦੇ ਦੌਰ ਵਿੱਚ ਕਾਫੀ ਗੇਮਾਂ ਖੇਡੀਆਂ ਹੋਈਆਂ ਹਨ ਜਿੱਦਾਂ ਵੱਖ ਵੱਖ ਤਰ੍ਹਾਂ ਦੀਆਂ ਗੇਮਾਂ ਖੇਡੀਆਂ ਹਨ ਜਿੱਦਾਂ ਹੁਣ ਅੱਜ ਕੱਲ੍ਹ ਚੱਲਣ ਦੀ ਪੱਬਜੀ ਪੱਬਜੀ ਚੱਲਣ ਦੀ ਪਰ ਪੁਰਾਣੇ ਟਾਈਮ ਵਿੱਚ ਚੱਲਦੀ ਹੁੰਦੀ ਸੀ ਕਲੈਸ਼ ਟੈਂਪਲ ਰਨ ਕਾਫੀ ਇਸ ਤਰ੍ਹਾਂ ਦੀਆਂ ਗੇਮਜ ਸੀ ਮਾਇੰਡ ਕਰਾਫਟ ਕਾਫੀ ਗੇਮਾਂ ਖੇਡੀਆਂ ਹੋਈਆਂ ਹਨ ਪਰ ਪੱਬਜੀ ਅੱਜ ਦੇ ਦੌਰ ਵਿੱਚ ਮੇਰੀ ਸਭ ਤੋਂ ਮਨਪਸੰਦ ਗੇਮ ਹੈ ਕਿਉਂਕਿ ਪੱਬਜੀ ਜਦੋਂ ਮੈਂ ਹੁਣ ਕੰਮ ਤੋਂ ਜਿੱਦਾਂ ਆਉਂਦਾ ਵਾ ਜਾਂ ਆਉਂਦਾ ਵਾਂ ਤਾਂ ਮੈਨੂੰ ਕਾਫੀ ਸਟ੍ਰੈੱਸ ਹੁੰਦਾ ਹੈ ਥੱਕਿਆ ਹੁੰਦਾ ਵਾ ਅਤੇ ਇੱਕ ਤਾਂ ਰਾਤੀ ਆਈ ਦਾ ਰਾਤੀ ਨੌ ਦਸ ਵਜੇ ਆਈ ਦਾ ਅਤੇ ਸਾਨੂੰ ਹੁੰਦਾ ਕਿ ਯਾਰ ਨਾ ਦੋਸਤਾਂ ਨਾਲ ਗੱਲ ਹੋਣੀ ਨਾ ਬਾਹਰ ਕਿਉਂਕਿ ਨੌ ਦਸ ਵਜੇ ਸਾਰੇ ਘਰ ਹੁੰਦੇ ਹੈ ਫੇਰ ਆਪਾਂ ਔ ਔਨਲਾਈਨ ਗੇਮ ਖੇਡਦੇ ਹਾਂ ਜਿਹਦੇ ਵਿੱਚ ਆਪਾਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ ਮਜ਼ਾਕ ਕਰ ਸਕਦੇ ਹਾਂ ਅਤੇ ਗੇਮ ਖੇਡ ਸਕਦੇ ਹਾਂ ਉਹਦੇ ਵਿੱਚ ਇੱਕ ਸਟ੍ਰੈੱਸ ਦੂਰ ਹੁੰਦਾ ਹੈ ਕਿ ਯਾਰਾ ਦੋਸਤਾਂ ਨਾਲ ਗੱਲ ਕਰਕੇ ਸਟ੍ਰੈੱਸ ਦੂਰ ਹੁੰਦਾ ਹੈ ਇਸ ਕਰਕੇ ਪੱਬਜੀ ਇਹ ਗੱਲੋਂ ਬਹੁਤ ਵਧੀਆ ਹੈਗੀ ਹੈ ਮ ਕਿ ਉਹਦੇ ਵਿੱਚ ਆਪਾਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਨ ਸਟ੍ਰੈੱਸ ਦੂਰ ਹੁੰਦਾ ਹੈ ਅਤੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਆਪਾਂ ਐਕਟੀਵਿਟੀ ਕਰ ਸਕਦੇ ਹਨ ਜਿੱਦਾਂ ਮੈਪ ਹੈ ਉੱਤਰ ਕੇ ਬੰਦੇ ਮਾਰਨੇ ਅੱਜ ਕੱਲ੍ਹ ਜਿੱਦਾਂ ਲੋਕ ਕਹਿੰਦੇ ਨਾ ਝੱਸ ਝੱਸ ਨਹੀਂ ਹੈ ਇਹ ਇੱਕ ਤੁਹਾਡੇ ਜਿਹੜੇ ਅੱਜ ਦੇ ਦੌਰ ਵਿੱਚ ਲੋਕਾਂ ਦਾ ਜਿਹੜੇ ਸਟ੍ਰੈੱਸ ਬੰਦੇ ਆ ਉਹ ਸਿਰਫ ਦੋ ਤਿੰਨ ਤਿੰਨ ਚਾਰ ਘੰਟੇ ਖੇਡ ਦੋ ਤਿੰਨ ਦੋ ਕੁ ਘੰਟੇ ਖੇਡਦੇ ਹੋਣਗੇ ਗੇਮ ਕਿ ਉਹ ਆਪਣਾ ਸਟ੍ਰੈੱਸ ਦੂਰ ਕਰ ਲੈਣ ਆਪਣੇ ਯਾਰਾ ਦੋਸਤਾਂ ਨਾਲ ਮਿਲ ਸਕਣ ਅਤੇ ਹੁਣ ਜਿੱਦਾਂ ਪੁਰਾਣਾ ਟਾਈਮ ਵਿੱਚ ਹੁੰਦੀ ਸੀ ਟੈਂਪਲ ਰਨ ਟੈਂਪਲ ਰਨ ਵਿੱਚ ਵੀ ਲੋਕ ਕਿਉਂ ਖੇਡਦੇ ਸੀ ਇੱਕ ਟਾਸਕ ਮਿਲੇ ਤੁਹਾਨੂੰ ਕਿ ਆਪਾਂ ਇਹਨੂੰ ਪਾਰ ਕਰਨਾ ਸਾਡਾ ਜਿਹੜਾ ਰਿਕੋਰਡ ਬਣਿਆ ਆਪਾਂ ਤੋੜਨਾ ਗੇਮਾਂ ਤੁਹਾਨੂੰ ਕਾਫੀ ਅੱਛੀ ਚੀਜ਼ਾਂ ਸਿਖਾਉਂਦੀਆਂ ਵੀ ਹੈ ਅਤੇ ਕਾਫੀ ਬੁਰੀਆਂ ਵੀ ਸਿਖਾਉਂਦੀਆਂ ਅੱਛੀ ਚੀਜ਼ਾਂ ਸਿਖਾਉਂਦੀਆਂ ਹਨ ਕਿ ਤੁਹਾਨੂੰ ਇੱਕ ਹੁੰਦਾ ਕਿ ਮੈਂ ਆਪਣਾ ਬੈਸਟ ਤੋਂ ਬੈਸਟ ਕਰਨਾ ਕਿ ਮੈਂ ਜੋ ਮੈਂ ਕੀਤਾ ਆ ਉਹ ਤੋਂ ਵੀ ਬੈਸਟ ਕਰਨ ਦੀ ਕੋਸ਼ਿਸ਼ ਕਰਨੀ ਹੈ ਜੋ ਉਹਨੂੰ ਉਹਦੇ ਵਿੱਚ ਸਿਖਾਇਆ ਜਾਂਦਾ ਪੱਬਜੀ ਵਿੱਚ ਵੀ ਹੁਣ ਇਸ ਤਰ੍ਹਾਂ ਹੀ ਹੈ ਕਿ ਸਾਨੂੰ ਰੈਂਕ ਆਪਣੀ ਉੱਪਰ ਕਰਨੀ ਹੁੰਦੀ ਹੈ ਸਾਨੂੰ ਉਹ ਰੈਂਕ ਕਿੱਦਾਂ ਉੱਪਰ ਕਰਨੀ ਹੈ ਕਿ ਆਪਣੀ ਤੁਸੀਂ ਸਕਿਲਸ ਵਧਾਉਣੀ ਹੈ ਸਕਿਲਸ ਵਧਾ ਕੇ ਆਪਣੀ ਰੈਂਕ ਉੱਪਰ ਕਰਨੀ ਹੈ ਹੁਣ ਸਕਿਲਸ ਵਧਾ ਕੇ ਆਪਣਾ ਜਿਹੜਾ ਆਪਣੇ ਜਿਹੜੇ ਦਿਮਾਗ ਨਾਲ ਤੁਸੀਂ ਕਿੱਦਾਂ ਖੇਡ ਸਕਦੇ ਹੋ ਮਲ ਕਿ ਹੁਣ ਜਿੱਦਾਂ ਸਿਚੁਏਸ਼ਨ ਆ ਜਾਂਦੀ ਹੈ ਕਿ ਉਹਦੇ ਵਿੱਚ ਤਾਂ ਲਾਸਟ ਜੋਨ ਹੈ ਤੁਹਾਨੂੰ ਬੰਦੇ ਮਾਰਨੇ ਹੈ ਅਤੇ ਕੀ ਕਰੋਗੇ ਤੁਸੀਂ ਆਪਣਾ ਦਿਮਾਗ ਯੂਜ ਕਰਦੇ ਹੋ ਆਪਣਾ ਫੁਲ ਦਿਮਾਗ ਯੂਜ ਕਰਦੇ ਹੋ ਅਤੇ ਆਪਣਾ ਯੂਜ ਕਰਕੇ ਕੋਸ਼ਿਸ਼ ਕਰਦੇ ਹੋ ਕਿ ਮੈਂ ਇਹ ਤੋਂ ਬਚਾਂ ਕਿੱਦਾਂ ਅਤੇ ਇਹੀ ਲਾਈਫ ਵਿੱਚ ਵੀ ਇੱਦਾਂ ਹੀ ਹੈ ਤੁਸੀਂ ਆਪਣਾ ਜਿਹੜਾ ਮੇਨ ਮੋਡ 'ਤੇ ਜਾਂ ਕੋਈ ਕਠਿਨਾਈ ਵਿੱਚ ਫਸ ਜਾਂਦੇ ਹੋ ਤਾਂ ਉਹਨੂੰ ਕਿਸ ਤਰ੍ਹਾਂ ਵਿੱਚੋਂ ਨਿਕਲਣ ਵਾਸਤੇ ਤੁਹਾਨੂੰ ਆਪਣਾ ਦਿਮਾਗ ਯੂਜ ਕਰਨਾ ਪੈਂਦਾ ਹੈ ਦਿਮਾਗ ਯੂਜ ਕਰਕੇ ਤੁਸੀਂ ਉਹਦੇ ਵਿੱਚੋਂ ਨਿਕਲ ਸਕਦੇ ਹੋ ਅਤੇ ਉਹੀ ਚੀਜ਼ਾਂ ਤੁਹਾਨੂੰ ਗੇਮਾਂ ਸਿਖਾਉਂਦੀਆਂ ਹਨ ਕਿ ਤੁਸੀਂ ਆਪਣਾ ਲੈਵਲ ਵੱਧ ਤੋਂ ਵੱਧ ਕਿੱਦਾਂ ਕਰ ਸਕਦੇ ਹੋ ਅਤੇ ਤੁਹਾਨੂੰ ਇਹ ਗੇਮਾਂ ਲੋਕਾਂ ਨੂੰ ਖੇਡਣੀਆਂ ਚਾਹੀਦੀਆਂ ਹੈ ਇਹੀ ਗੇਮਾਂ ਨਹੀਂ ਹਰ ਜਿਹੜੀ ਆਊਟ ਡੋਰਿੰਗ ਗੇਮਾਂ ਜਿੱਦਾਂ ਹੁਣ ਬਿਨਾ ਫੋਨ ਤੋਂ ਵੀ ਗੇਮਾਂ ਉਹ ਵੀ ਤੁਹਾਨੂੰ ਖੇਡਣੀਆਂ ਚਾਹੀਦੀਆਂ ਹਨ ਉਹ ਵੀ ਕਾਫੀ ਵਧੀਆ ਚੀਜ਼ਾਂ ਹੁੰਦੀਆਂ ਹਨ ਤੁਹਾਨੂੰ ਗੇਮਾਂ ਖੇਡਣੀਆਂ ਹੀ ਚਾਹੀਦੀਆਂ ਹਨ ਅੱਜ ਦੇ ਟਾਈਮ 'ਚ ਲੋਕ ਗੇਮਾਂ ਦੇ ਆਦੀ ਹੋ ਗਏ ਪਰ ਉਹਨਾਂ ਨੂੰ ਆਦੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਮਜ਼ੇ ਵਾਸਤੇ ਅਤੇ ਇੱਕ ਆਪਣਾ ਟਾਸਕ ਕਰਨ ਵਾਸਤੇ ਗੇਮ ਖੇਡਣੀ ਚਾਹੀਦੀ